ਹਾਂਜੀ ਸਤਿ ਸ਼੍ਰੀ ਅਕਾਲ ਹਾਂ ਮੈਂ ਦਿਲਜੀਤ ਬੋਲਦੀ ਹਾਂ ਪੂਜਾ ਪਛਾਣਿਆ ਨਹੀਂ ਮੈਨੂੰ ਮਸਾਂ ਲੱਭਿਆ ਫੋਨ ਨੰਬਰ ਤੇਰਾ ਮੇਰੀ ਭਾਬੀ ਤੋਂ ਹਮ ਚਲੋ ਹੁਣ ਫੀਡ ਕਰਲੀ ਨੰਬਰ ਠੀਕ ਆ ਅਤੇ ਹੋਰ ਕਿੱਥੇ ਵਿਆਹੀ ਆ ਅੱਛਾ ਲੈ ਹੋਰ ਪਿੰਡ 'ਚ ਜੀ ਲੱਗ ਜਾਂਦਾ ਨਹੀਂ ਸ਼ਹਿਰ ਦੀ ਤਾਂ ਬਹੁਤੀ ਸੌਖੀ ਹੈ ਪਤਾ ਕੀ ਹੈ ਸ਼ਹਿਰ 'ਚ ਇਹ ਆ ਕਿ ਚਲੋ ਮੇਰੀ ਵਰਗੀ ਰਾਤ ਨੂੰ ਜਦੋ ਮਰਜੀ ਚਲ ਜੋ ਬੈਕਾਂ ਵੀ ਨੇੜੇ ਆ ਹੈ ਨਾ ਮੇਰਾ ਤਾਂ ਘਰ ਵੀ ਮੈਨ ਰੋਡ 'ਤੇ ਆ ਹੈਂ ਹਾਂ ਹਾਂ ਮੇਰਾ ਜਮਾਂ ਨੇੜੇ ਆ ਅੱਡੇ ਦੀ ਸਹੂਲਤ ਮੈਨੂੰ ਨੇੜੇ ਆ ਹੈ ਨਾ ਤੇ ਮੁੜ ਕੇ ਮੈਂ ਮੇਨ ਰੋਡ 'ਤੇ ਆ ਅਤੇ ਸਾਹਮਣੇ ਬੈਂਕਾਂ ਦੋ ਤਿੰਨ ਅਤੇ ਨਾਲ ਹੀ ਸ਼ੋਅਰੂਮ ਹੈ ਸਾਡੇ ਜਿਵੇਂ ਰੇਡੀਮੇਡ ਕੱਪੜਿਆਂ ਦੇ ਅਤੇ ਮੈਂ ਤਾਂ ਬੈਠੀ ਵੀ ਨੇੜੇ ਹਾਂ ਹਾਂ ਹਾਂ ਹਾਂ ਹਾਂ ਨਹੀਂ ਉਹ ਤਾਂ ਹੈਗਾ ਹਾਂ ਹਾਂ ਨਾਲੇ ਨਾ ਪਤਾ ਕੀ ਆ ਸ਼ਹਿਰ ਦੇ ਵਿੱਚ ਬਿਜਨਸ ਵੀ ਚਲਾ ਲਓ ਕੋਈ ਜਿਵੇਂ ਹੁਣ ਇਹਨਾਂ ਨੇ ਸਾਡੇ ਮੇਨ ਰੋਡ 'ਤੇ ਆ ਮੈਂ ਇਹਨਾਂ ਨੂੰ ਕਿਹਾ ਕਿ ਚੱਲ ਜੋ ਵੀ ਹੈ ਮਤਲਬ ਮੈਂ ਵੀ ਆਪਦਾ ਕੰਮ ਸ਼ੁਰੂ ਕੀਤਾ ਬਹੁਤ ਵਧੀਆ ਚੱਲ ਪਿਆ ਪਿੰਡਾਂ 'ਚ ਤਾ ਲੋਕ ਵੈਸੇ ਵੀ ਮੈਂ ਸਟਚਿੰਗ ਦਾ ਸ਼ੁਰੂ ਕਰ ਲਿਆ ਹੈ ਨਾ ਹਾਂ ਅਤੇ ਇਹਨਾਂ ਦਾ ਕੰਮ ਵਧੀਆ ਹਾਂ ਵਧੀਆ ਚੱਲ ਪਿਆ ਪਿੰਡਾਂ ਆਲੇ ਸਗੋਂ ਪੈਸੇ ਨਹੀਂ ਭਰਦੇ ਹਾਂ ਹਾਂ ਹੁਣ ਆਹ ਨਾਲ ਸ਼ੋਅਰੂਮ ਮੈਂ ਕਹਿੰਦੀ ਆ ਪਰਸੋਂ ਚੜਿਆ ਪਰਸੋਂ ਚੜਿਆ ਸ਼ੋਅਰੂਮ ਨਾਲ ਅਤੇ ਇੰਨੇ ਵਧੀਆਂ ਸੱਤਰ ਹਜ਼ਾਰ ਯਾਨੀ ਕੇ ਵੀ ਇੰਨਕਮ ਹੈ ਮਹੀਨੇ ਦੀ ਤੇ ਮੈਂ ਕਿਹਾ ਚੱਲ ਇਹਨਾਂ ਨੂੰ ਹਾਂ ਨਹੀਂ ਨਹੀਂ ਸ਼ਹੀਰਾਂ ਵਿੱਚ ਤਾਂ ਵੈਸੇ ਵੀ ਸਹੁਲੂਤ ਸਾਡੇ ਇੱਥੇ ਮੈਡੀਕਲ ਹੈ ਵੱਡਾ ਹੁਣ ਪਿੰਡਾਂ 'ਚ ਨਹੀਂ ਹੈ ਕਿੰਨਾ ਮੁਸ਼ਕਿਲ ਹੋ ਜਾਂਦਾ ਹੁਣ ਹਾਂ ਫਿਰ ਇਹ ਗਲਤ ਗੱਲ ਸ਼ਹਿਰ ਤੂੰ ਹੀ ਸ਼ਿਫਟ ਹੋ ਜਾ ਇੱਧਰ ਸ਼ਹਿਰ ਪੜੀ ਜਾਣੀ ਕਿ ਨਾ ਪਤਾ ਕਿ ਨਾਲੇ ਬੱਚਿਆਂ ਦੀ ਪੜ੍ਹਾਈ ਪੜੁਈ ਬਾਰੇ ਸਹੂਲਤਾਂ ਹੈਗੀਆਂ ਨੇ ਕਾਲਜ ਅਕੈਡਮੀਆਂ ਬਣੀਆਂ ਹੋਈਆਂ ਹੈ ਨਾ ਯੂਨੀਵਰਸਟੀਆਂ ਹਾਂ ਦੇਖ ਇੱਥੇ ਹੀ ਯੂਨੀਵਰਸਿਟੀ ਆ ਜਿਹੜੀ ਬਾਬਾ ਫਰੀਦ ਯੂਨੀਵਰਸਿਟੀ ਆ ਸਾਡੇ ਹੈ ਨਾ ਅਤੇ ਇਹ ਨਹੀਂ ਕਿਤੇ ਲੁਧਿਆਣੇ ਜਾਣਾ ਪਵੇਗਾ ਜਾਂ ਕੁਛ ਵੀ ਹੈ ਮੈਂ ਵਿਆਹ ਕਰਨਾ ਗਾ ਕੁੜੀ ਦਾ ਅਤੇ ਮੈਂ ਵੱਧ ਤੋਂ ਵੱਧ ਯਾਨੀ ਕਿ ਸ਼ੋਪਿੰਗ ਮੈਂ ਇੱਥੋਂ ਹੀ ਕਰ ਲੈਣੀ ਆ ਫਰੀਦਕੋਟ ਤੋਂ ਹੀ ਹਾਂ ਨਹੀਂ ਸੋ

ਹਮ ਹਮ ਮੈਂ ਅੱਜ ਹੀ ਮੈਂ ਸੋਚਿਆ ਸੀ ਮੈਂ ਇਹਨਾਂ ਨੂੰ ਕਿਹਾ ਸੀ ਮੈਂ ਕਿਹਾ ਵੇਖ ਕੇ ਆਈਏ ਨਿੱਕੇ ਨਿੱਕੇ ਨਾ ਸੋਨੇ ਦੀ ਚੀਜ਼ ਬਣਾ ਲਈਏ ਹੁਣ ਪਿੰਡਾਂ 'ਚੋਂ ਵੀ ਦੇਖ ਮੇਰੀਆਂ ਨਾ ਫਰੈਂਡਾਂ ਆਉਂਦੀਆਂ ਜਿਹੜੀ ਮੇਰੀਆਂ ਸਟਚਿੰਗ ਕਰਾਉਣੀਆਂ ਅਤੇ ਉਹਨਾਂ ਨੇ ਯਾਨੀ ਕੇ ਪਹਿਲਾਂ ਘਰ ਵਾਲਿਆਂ ਨੂੰ ਇੱਕ ਵਾਰੀ ਫਿਰ ਆਉਂਦੀਆਂ ਫਰੀਦਕੋਟ ਅਤੇ ਬੜਾ ਔਖਾ ਮਤਲਬ ਨਾ ਤਾਂ ਸਾਧਨ ਮਿਲਦਾ ਕਈ ਵਾਰ ਹੈ ਨਾ ਇੱਥੇ ਤਾਂ ਚੁੱਕੋ ਅਤੇ ਆਪ ਤੂਰ ਪੋ ਹਾਂ ਮੈਨੂੰ ਤਾਂ ਬਸ ਸੋਖ ਬਹੁਤ ਏ ਭੈਣੇ ਹਾਂ ਨਹੀਂ ਨਹੀਂ ਸ਼ਹਿਰ ਦਾ ਬਹੁਤ ਫਰਕ ਆ ਪਿੰਡ ਨਾਲ ਪਿੰਡ 'ਚ ਇਹ ਆ ਕਿ ਉੱਥੇ ਚਲੋ ਖੇਤੀਬਾੜੀ ਕਰਕੇ ਦਾਲ ਆਪਦੀਆਂ ਸਬਜ਼ੀਆਂ ਘਰ ਦੀਆਂ ਹੋ ਜਾਂਦੀਆਂ ਹਾਂ ਇਹ ਪਤਾ ਕੀ ਏ ਸਾਰੀਆਂ ਚੀਜ਼ਾਂ ਫਿਰ ਇੱਕ ਥਾਵੇਂ ਤਾਂ ਨਹੀਂ ਮਿਲਦੀਆਂ ਚਲੋ ਮੰਨ ਲਿਆ ਪਰ ਇਹ ਹੈ ਵੀ ਇਕੱਲਾ ਆਪਾਂ ਹੁਣ ਦਾਲ ਸਬਜ਼ੀਆਂ ਨੂੰ ਵੀ ਬੱਚਿਆਂ ਦੀ ਖਾਉਂਦੇ ਹੋ ਯਾਨੀ ਕਿ ਜਿਹੜੇ ਹੁਣ ਅਗਾਂਹ ਵਧਣਾ ਉਹਨਾਂ ਨੇ ਪੜ੍ਹਾਈਆਂ ਕਰਨੀਆਂ ਹੈ ਨਾ ਉਹਦੇ ਭਵਿੱਖ ਵਾਸਤੇ ਆਪਾਂ ਦੇਖਣਾ ਹੀ ਆ ਕਿ ਆਪਾਂ ਨੂੰ ਸ਼ਿਫਟ ਹੋਇਆ ਮੈਂ ਤਾਂ ਆਪਣੀ ਫਰੈਂਡ ਨੂੰ ਵੀ ਕਹਿੰਦੀ ਹੁੰਦੀ ਆ ਤੁਸੀਂ ਸ਼ਿਫਟ ਹੋ ਜੋ ਤੁਸੀਂ ਉੱਥੇ ਰਹਿਣ ਦਿਓ ਅਤੇ ਸ਼ਹਿਰ ਦਾ ਜ਼ਿਆਦਾ ਹਾਂ ਨਹੀਂ ਨਹੀਂ ਉਹ ਤਾਂ ਹੈ ਹਾਂ ਹਾਂ ਫਿਰ ਪੁਰਾਣੇ ਬੰਦੇ ਨਾ ਪਿੰਡ ਨੂੰ ਚੰਗਾ ਸਮਝਦੇ ਪਰ ਪਿੰਡ ਵੀ ਸਹੀ ਆ ਮਤਲਬ ਸ਼ਹਿਰ ਅੱਜ ਦੇ ਜ਼ਮਾਨੇ 'ਚ ਸਹੀ ਆ ਅੱਜ ਦੇ ਜ਼ਮਾਨੇ 'ਚ ਸ਼ਹਿਰ ਸਹੀ ਆ ਠੀਕ ਆ ਹਾਂ ਨਹੀਂ ਨਹੀਂ ਸਹੂਲਤਾਂ ਮੁਤਾਬਿਕ ਆਪਾਂ ਕਹਿੰਦੇ ਹਾਂ ਕਿ ਉੱਥੇ ਹੀ ਸਹੀ ਆ ਕਿਉਂਕਿ ਪਿੰਡ 'ਚ ਇੱਕੋ ਦਮ ਨਹੀਂ ਸਾਰੇ ਕੰਮ ਹੁੰਦੇ ਮਤਲਬ ਠੀਕ ਆ ਜ਼ਮੀਨਾਂ ਹੈਗੀਆਂ ਵੱਡੇ ਬਜ਼ੁਰਗਾਂ ਦਾ ਜੀ ਕਰਤਾ ਉੱਥੇ ਰਹਿਣ ਨੂੰ ਪਰ ਉਹ ਇਹ ਵੀ ਦੇਖਣ ਨਾ ਬੱਚਿਆਂ ਦੀ ਭਵਿੱਖ ਆਪਾਂ ਬਣਾਉਣਾ ਅਤੇ ਆਪਾਂ ਨੂੰ ਅਪ ਡਾਊਨ ਕੌਣ ਇਕੱਲੇ ਇਕੱਲੇ ਅੱਜ ਕੱਲ੍ਹ ਹੈਗੇ ਆ ਹੈਨਾ ਉਹਨੂੰ ਕੋਈ ਨਾਂ ਲੈ ਕੇ ਜਾਂਦਾ ਹਾਂ ਅੱਜ ਕੱਲ੍ਹ ਨਾਲੇ ਵੇਲਾ ਵੀ ਨਹੀਂ ਹੈਗਾ ਬੱਸਾਂ ਤੇ ਗੜੇ ਦੇਣ ਦਾ ਹਾਂ ਹਾਂ ਹਾਂ ਨਹੀਂ ਨਹੀਂ ਕੋਈ ਨਹੀਂ ਮੈਂ ਵੇਖ ਲੂਗੀ ਮੇਰਾ ਫਰੀਦਕੋਟ ਬੈਠੀ ਸ਼ਹਿਰ ਦੇ ਵਿੱਚ ਜਿੱਥੇ ਮਰਜ਼ੀ ਦੱਸ ਤੈਨੂੰ ਮੈਂ ਆਪੇ ਵੇਖ ਲੂੰਗੀ ਕੋਈ ਨਹੀਂ ਆ ਜੀ ਹਾਂ ਠੀਕ ਠੀਕ ਆ ਹਾਂ ਨਹੀਂ ਕੋਈ ਨਹੀਂ ਹਾਂ ਆਈ ਜ਼ਰੂਰ ਆਈ ਪੂਜਾ ਮੈਂ ਤਾਂ ਵਾਹਵਾ ਦਿਨਾਂ ਬਾਅਦ ਮਿਲਾਂਗੇ ਆਪਾਂ ਦੱਬ ਕੇ ਆਏ ਠੀਕ ਆ ਰਹੇ ਠੀਕ ਆ ਪੂਜਾ ਹਾਂਜੀ ਠੀਕ ਆ